ਸਰਕਾਰੀ ਸਕੀਮਾਂ ਅਧੀਨ ਦਿੱਤੀਆਂ ਜਾਂਦੀਆਂ ਸਿਹਤ ਸੇਵਾਵਾਂ ਬਹੁਤ ਵਧੀਆ ਹਨ ਜਿਸ ਨਾਲ ਸਾਨੂੰ ਸ ਸਿਹਤ ਪ ਪੱਖੋਂ ਬਹੁਤ ਲਾਭ ਮਿਲਦਾ ਹੈ ਅਗਰ ਅਸੀਂ ਗੱਲ ਕਰੀਏ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਦੀ ਤਾਂ ਸਰਕਾਰੀ ਹਸਪਤਾਲ ਜਾਣਾ ਮੈਂ ਬਹੁਤ ਜ਼ਿਆਦਾ ਪਸੰਦ ਕਰਦਾ ਹਨ ਕਿਉਂਕਿ ਉੱਥੇ ਬਹੁਤ ਹੀ ਹੁਨਰਮੰਦ ਡਾਕਟਰ ਹਨ ਸਰਕਾਰੀ ਹਸਪਤਾਲ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਕੋਈ ਫਰਕ ਜ਼ਿਆਦਾ ਖਾਸ ਫਰਕ ਨਹੀਂ ਹੈ ਸਰਕਾਰੀ ਹਸਪਤਾਲਾਂ ਵਿੱਚ ਜ਼ਿਆਦਾ ਨਿਪੁੰਨ ਡਾਕਟਰ ਹਨ ਜਦਕਿ ਪ੍ਰਾਈਵੇਟ ਹਸਪਤਾਲਾਂ ਵਿੱਚ ਇੰਨੀ ਨਿਪੁੰਨਤਾਂ ਨਹੀਂ ਪਾਈ ਜਾਂਦੀ